ਭੰਗੜੇ ਦੇ ਪ੍ਰਦਰਸ਼ਨ ਲਈ ਆਮ ਤੌਰ 'ਤੇ ਲਹਿੰਗਾ ਚੋਲੀ ਜਾਂ ਪਟਿਆਲਾ ਸਲਵਾਰ ਸੂਟ ਜਾਂ ਮੁੰਡੇ ਪੰਜਾਬੀ ਮੁੰਡੇ ਜਿਹੜੇ ਪੱਗਾਂ ਬੰਨ੍ਹ ਕੇ ਭੰਗੜੇ ਨੂੰ ਦਰਸਾਉਂਦੇ ਨੇ ਆਮ ਤੌਰ 'ਤੇ ਸਾਡੇ ਪੰਜਾਬੀ ਸਭਿਆਚਾਰ ਵਿੱਚ ਭੰਗੜੇ ਦੀ ਇੱਕ ਅਲੱਗ ਹੀ ਮਹੱਤਤਾ ਹੈ ਜਿਸਨੂੰ ਮੁਟਿਆਰ ਅਤੇ ਗੱਭਰੂ ਗੱਭਰੂ ਜਵਾਨ ਬੜੇ ਹੀ ਚਾਅ ਦੇ ਨਾਲ ਇਹਨੂੰ ਭੰਗੜੇ ਨੂੰ ਦਰਸਾਉਂਦੇ ਹਨ ਇਹ ਬੜੇ ਚਾਅ ਨਾਲ ਤਿਆਰ ਹੋ ਕੇ ਹਰ ਤਿਉਹਾਰ 'ਤੇ ਉਹ ਭੰਗੜਾ ਜ਼ਰੂਰ ਸਾਡੇ ਪੰਜਾਬ ਵਿੱਚ ਪਾਇਆ ਜਾਂਦਾ ਹੈ ਜਿਸ ਨੂੰ ਬੱਚੇ ਵੱਡੇ ਬਜ਼ੁਰਗ ਸਾਰੇ ਹੀ ਬੜੇ ਚਾਅ ਦੇ ਨਾਲ ਭੰਗੜਾ ਕਰਦੇ ਹਨ ਅਤੇ ਆਪਣੇ ਖੁਸ਼ੀ ਨੂੰ ਜਾਹਰ ਕਰਦੇ ਹਨ ਭੰਗੜਾ ਸਾਡੇ ਪੰਜਾਬ ਵਿੱਚ ਬਹੁਤ ਹੀ ਵਧੀਆ ਮੰਨਿਆ ਗਿਆ ਹੈ ਸਾਡੀ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਸਾਡੀ ਕੋਈ ਵੀ ਖੁਸ਼ੀ ਭੰਗੜੇ ਤੋਂ ਬਗੈਰ ਪੂਰੀ ਹੀ ਨਹੀਂ ਹੁੰਦੀ ਅਗਰ ਭੰਗੜਾ ਨਾ ਕੀਤਾ ਜਾਵੇ ਤਾਂ ਸਾਡਾ ਤਿਉਹਾਰ ਵੀ ਸਾਡੀਆਂ ਖੁਸ਼ੀਆਂ ਵੀ ਸਾਡਾ ਸਭ ਕੁਝ ਅਧੂਰਾ ਹੀ ਰਹਿ ਜਾਂਦਾ ਹੈ ਭੰਗੜੇ ਤੋਂ ਬਿਨਾਂ ਸਾਡਾ ਤਿਉਹਾਰ ਤਿਉਹਾਰ ਹੀ ਨਹੀਂ ਲੱਗਦਾ ਦਿਵਾਲੀ ਹੋਲੀ ਹਰ ਤਿਉਹਾਰ 'ਤੇ ਅਸੀਂ ਭੰਗੜੇ ਨਾਲ ਹੀ ਸ਼ੁਰੂਆਤ ਕਰਦੇ ਹਾਂ ਜਿਸ ਨਾਲ ਮਨੋਰੰਜਨ ਦਾ ਇੱਕ ਜ਼ਰੀਆ ਵੀ ਬਣਦਾ ਹੈ ਅਤੇ ਸਾਡਾ ਉਤਸਾਹ ਵੀ ਵੱਧਦਾ ਹੈ ਅਤੇ ਸਾਡੀਆਂ ਖੁਸ਼ੀਆਂ ਵਿੱਚ ਵੀ ਵਾਧਾ ਹੁੰਦਾ ਹੈ ਧੰਨਵਾਦ